ਵੈਸੇ ਤਾਂ ਪੂਰੇ ਭਾਰਤ ਵਿੱਚ ਸੈਲਾਨੀਆਂ ਦੇ ਆਕਰਸ਼ਣ ਦੇ ਬਹੁਤ ਹੀ ਕੇਂਦਰ ਹਨ ਪਰ ਮੈਂ ਅੱਜ ਆਪਣੇ ਪੰਜਾਬ ਦੀ ਗੱਲ ਕਰਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਣੇ ਵਿਰਾਸਤ ਏ ਖਾਲਸਾ ਜੋ ਕਿ ਪੰਜਾਬ ਦੇ ਹੀ ਸੈਲਾਨੀ ਨਹੀਂ ਵੱਖ ਵੱਖ ਹੋਰ ਸਟੇਟਾਂ ਦੇ ਪੂਰੇ ਇੰਡੀਆ ਤੋਂ ਇੰਡੀਆ ਤੋਂ ਬਾਹਰ ਔਰ ਇੰਟਰਨਨੈਸ਼ਨਲ ਸੈਲਾਨੀ ਵੀ ਵਿਰਾਸਤ ਏ ਖਾਲਸਾ ਨੂੰ ਦੇਖਣ ਲਈ ਆਉਂਦੇ ਨੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਔਰ ਜੋ ਵੀ ਉਹਨਾਂ ਦੇ ਕਮਿਊਨਿਟੀ ਦੇ ਹੋਰ ਵੀ ਹੈ ਸਿੱਖ ਧਰਮ ਦੇ ਬਾਰੇ ਦੱਸਦੇ ਨੇ ਜੋ ਵੀ ਸਿੱਖ ਧਰਮ ਦਾ ਇਤਿਹਾਸ ਉਸ ਵਿਰਾਸਤ ਏ ਖਾਲਸਾ ਦੇ ਵਿੱਚ ਐਜ ਏ ਵੀਡੀਓ ਰਾਹੀਂ ਔਰ ਆਡੀਓ ਰਾਹੀਂ ਉਹਨਾਂ ਨੂੰ ਏਅਰਫ਼ੋਨ ਲਗਾ ਕੇ ਦੱਸਿਆ ਜਾਂਦਾ ਹੈ